ਸੋਸ਼ਲ ਮੀਡੀਆ ਨੇ ਡਾਂਸ ਟਟੋਰੀਅਲ ਉਦਯੋਗ 'ਤੇ ਕਾਫ਼ੀ ਗਹਿਰਾ ਪ੍ਰਭਾਵ ਪਾਇਆ ਹੈ ਇਸਨੇ ਡਾਂਸ ਸਿੱਖਣ ਦੇ ਤਰੀਕਿਆਂ ਨੂੰ ਬਦਲ ਦਿੱਤਾ ਹੈ ਅਤੇ ਕੁਝ ਮਹੱਤਵਪੂਰਨ ਘਟਨਾਵਾਂ ਨੂੰ ਜਨਮ ਦਿੱਤਾ ਹੈ ਟਿੱਕਟੋਕ ਅਤੇ ਇੰਸਟਾਗਰਾਮ 'ਤੇ ਵਾਇਰਲ ਚੁਣੌਤੀਆਂ ਨੇ ਜਿਵੇਂ ਡਾਂਸ ਨੇ ਵਿਦਿਆਰਥੀਆਂ ਦੇ ਅਤੇ ਸਾਡੇ ਨਵੇਂ ਡਾਂਸਰਾਂ ਨੂੰ ਪ੍ਰੇਰਿਤ ਕੀਤਾ ਹੈ ਇਹ ਚੁਣੌਤੀਆਂ ਬਹੁਤ ਤੇਜੀ ਨਾਲ ਫੈਲ ਜਾਂਦੀਆਂ ਨੇ ਇਸ ਨਾਲ ਲੋਕਾਂ ਦਾ ਧਿਆਨ ਖਿੱਚਣਾ ਆਸਾਨ ਹੋ ਜਾਂਦਾ ਹੈ ਜੋ ਇੱਕ ਸੋਸ਼ਲ ਮੀਡੀਆ ਦੇ ਉੱਪਰ ਜੋ ਛੋਟੀਆਂ ਛੋਟੀਆਂ ਕਲਿਪਾਂ ਖ਼ਾਸ ਕਰਕੇ ਇੰਸਟਾਗਰਾਮ 'ਤੇ ਟਿੱਕਟੋਕ 'ਤੇ ਜੋ ਚਲਾਈਆਂ ਜਾਂਦੀਆਂ ਨੇ ਉਹ ਲੋਕਾਂ ਨੂੰ ਇੱਕਦਮ ਆਕਰਸ਼ਿਤ ਕਰਦੀਆਂ ਨੇ ਉਹ ਬਹੁਤ ਤੇਜੀ ਨਾਲ ਲੋਕਾਂ ਦੇ ਵਿੱਚ ਫੈਲਦੀਆਂ ਨੇ ਵੱਡੇ ਪੈਮਾਨੇ 'ਤੇ ਜੋ ਬੱਚੇ ਨੇ ਉਹ ਆਪਣੀ ਕਲਾ ਦਾ ਜਿਹੜਾ ਪ੍ਰਦਰਸ਼ਨ ਉਹ ਇਸਲ ਪਲੇਟਫੋਰਮ ਦੇ ਉੱਪਰ ਕਰ ਪਾਉਂਦੇ ਨੇ ਜੋ ਆਪਣੀਆਂ ਜੋ ਬੱਚੇ ਆਪਣੀਆਂ ਜਾਂ ਕੋਈ ਵੀ ਹੈ ਆਪਣੀ ਡਾਂਸ ਦੀ ਵੀਡੀਓ ਮਤਲਬ ਵੀਡੀਓ ਸ਼ੂਟ ਕਰਕੇ ਉਸਨੂੰ ਕਿਸੇ ਸੋਸ਼ਲ ਮੀਡੀਆ 'ਤੇ ਪਾ ਪਾਉਂਦਾ ਗਾ ਤਾਂ ਉਹ ਉਹਨਾਂ ਦਾ ਜਿਹੜਾ ਉਹ ਲੋਕਾਂ ਦੇ ਨਾਲ ਬਹੁਤ ਤੇਜੀ ਦੇ ਨਾਲ ਜੁੜਦਾ ਕਿਉਂਕਿ ਛੋਟੀਆਂ ਛੋਟੀਆਂ ਛੋਟੀਆਂ ਕਲਿੱਪਾਂ ਉਹ ਬਹੁਤ ਤੇਜੀ ਨਾਲ ਵਾਇਰਲ ਹੋ ਜਾਂਦੀਆਂ ਨੇ ਇਸ ਕਰਕੇ ਜਿਹੜਾ ਇਹ ਡਾਂਸ ਕਲਾਸਾਂ ਨੇਗੀਆਂ ਜਾਂ ਇਹ ਚੀਜ਼ਾਂ ਉਦਯੋਗ ਸੀਗਾ ਉਸ ਨੂੰ ਕਾਫ਼ੀ ਮਤਲਬ ਸੱਟ ਮਾਰੀ ਇਸ ਚੀਜ਼ ਨੇ

ਸੋਸ਼ਲ ਮੀਡੀਆ ਪਲੇਟਫਾਰਮ ਨੇ ਸਾਰੀ ਦੁਨੀਆਂ ਦੇ ਲੋਕਾਂ ਲਈ ਆਪਣੀ ਕਲਾ ਦਾ ਪ੍ਰਦਰਸ਼ਨ ਦੀ ਯੋਜਨਾ ਨੂੰ ਵੱਡੇ ਪੈਮਾਨੇ 'ਤੇ ਪਹੁੰਚਾ ਦਿੱਤੀ ਹੈ ਹੁਣ ਕੋਈ ਵੀ ਵਿਅਕਤੀ ਆਪਣੀ ਟਟੋਰੀਅਲ ਜਾਂ ਨਿੱਜੀ ਡਾਂਸ ਵੀਡੀਓ ਨੂੰ ਜਿਹੜਾ ਦੁਨੀਆਂ ਦੇ ਨਾਲ ਸਾਂਝਾ ਕਰ ਸਕਦਾ ਬਹੁਤ ਸਾਰੇ ਸਿੱਖਿਆ ਦੇਣ ਵਾਲੇ ਅਭਿਨੇਤਾ ਅਤੇ ਹੋਰ ਜਿਹੜੇ ਡਾਂਸ ਮਾਸਟਰ ਨੇ ਜਿਹੜੇ ਫੋਲੋਅਰਾਂ ਨਾਲ ਆਪਣੇ ਡਾਂਸ ਨਾਲ ਜੁੜ ਕੇ ਟਟੋਰੀਅਲ ਸਾਂਝੇ ਕਰਦੇ ਕਰਦੇ ਹਨ ਆਪਣੀ ਫੇਸ ਮਤਲਬ ਜਿਹੜੀ ਫੈਨ ਬੇਸ ਹੈਗੀ ਉਹਨੂੰ ਵੀ ਵਧਾਉਂਦੇ ਨੇਗੇ ਅਤੇ ਡਾਂਸ ਟਟੋਰੀਅਲਾਂ ਨੂੰ ਛੋਟੇ ਕਲਿੱਪਾਂ ਵਿੱਚ ਜਿਹੜਾ ਪੇਸ਼ ਕੀਤਾ ਜਾਂਦਾ ਜਿਸ ਨਾਲ ਸਿੱਖਣ ਦੀ ਪ੍ਰਕਿਰਿਆ ਤੇਜ ਅਤੇ ਮਨੋਰੰਜਕ ਬਣ ਜਾਂਦੀ ਹੈ ਬਹੁਤ ਜ਼ਿਆਦਾ ਇੰਟਰਸਟਿੰਗ ਬਣ ਜਾਂਦੀ ਹੈ ਇਹਦੇ ਵਿੱਚ ਐਂ ਆ ਕੋਪੀਟੀਸ਼ਨ ਦੇ ਮੁਕਾਬਲੇ ਵੀ ਹੈਗੇ ਨੇ ਜਿਵੇਂ ਵੱਡੇ ਵੱਡੇ ਮੁਕਾਬਲਿਆਂ ਨੇ ਡਾਂਸ ਦੇ ਹੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਪ੍ਰਚੱਲਿਤ ਨੇਗੇ ਕਾਫ਼ੀ ਡਾਂਸ ਸ਼ੋਅ ਨੇਗੇ ਜਿਵੇਂ ਡਾਂਸ ਇੰਡੀਆ ਡਾਂਸ ਜਿਵੇਂ ਅਮਰੀਕਾ ਦਾ ਬਹੁਤ ਵੱਡਾ ਸ਼ੋਅ ਹੈਗਾ ਅਮਰੀਕਾਸ ਬੈਸਟ ਡਾਂਸ ਕ੍ਰੀਉ ਅਤੇ ਬਹੁਤ ਵੱਡੇ ਵੱਡੇ ਜਿਹੜੇ ਫੈਸਟੀਵਲ ਨੇ ਡਾਂਸ ਨੂੰ ਲੈ ਕੇ ਹੁੰਦੇ ਆਏ ਨੇ ਇਹ ਸਭ ਗੱਲਾਂ ਦਰਸਾਉਂਦੀਆਂ ਨੇ ਕਿ ਸ਼ੋਸਲ ਮੀਡੀਆ ਨੇ ਡਾਂਸ ਦੇ ਉਦਯੋਗ ਨੂੰ ਹੈ ਜਿਹੜਾ ਕਿਵੇਂ ਪ੍ਰਗਟ ਕੀਤਾ ਹੈ ਅਤੇ ਇਸ ਦੀ ਸਿੱਖਣ ਦੀ ਜਿਹੜੀ ਪ੍ਰਕਿਰਿਆ ਹੈਗੀ ਤੇ ਉਸ 'ਤੇ ਕਿੰਨਾ ਕ ਬੁਨਿਆਦੀ ਪ੍ਰਭਾਵ ਪਾਇਆ